ਅੱਜ ਕੱਲ ਦੇ ਜਮਾਨੇ 'ਚ ਇੰਟਰਨੈਸ਼ਨਲ ਵੱਧ ਗਿਆ ਤੇ ਇਨੇ ਇੰਟਰਨੈਟ ਤੇ ਉਹ ਸਾਰੇ ਹੀ ਭਾ ਚੱਲਣ ਲੱਗ ਪਏ ਜਿਵੇਂ ਟੀਬੀ ਚੱਲਣ ਲੱਗ ਗਏ ਐਲ ਸੀ ਡੀ ਆ ਫੋਨ ਘੜੀਆਂ ਤੇ ਹੋਰ ਤਰ੍ਹਾਂ ਦੇ ਸਾਧਨ ਚੱਲ ਪਏ ਪਰ ਮੈਂ ਇੰਨਾ ਪੜੀ ਲਿਖੀ ਨਹੀਂ ਕਿ ਉਹ ਮੈਨੂੰ ਨੋਲੇਜ ਇੰਨੀ ਜੀਆਦਾ ਨਹੀਂ ਹੈ ਤੇ ਮੇਰੇ ਬੱਚੇ ਮੈਨੂੰ ਇਹਨਾਂ ਗੱਲਾਂ ਬਾਰੇ ਰੋਜ਼ ਨਵੇਂ ਨਵੇਂ ਤਰੀਕਿਆਂ ਬਾਰੇ ਦੱਸਦੇ ਹਨ ਤੇ ਮੈਂ ਉਹਨਾਂ ਤੋਂ ਹੀ ਸਿੱਖ ਲੈਂਦੀ ਹਾਂ ਪਰ ਮੈਂ ਇਨਾ ਪੜ੍ਹੀ ਲਿਖੀ ਨਹੀਂ ਹਾਂ ਤੇ ਮੇਰੇ ਬੇਟਾ ਮੈਨੂੰ ਇਹਨਾਂ ਚੀਜ਼ਾਂ ਨੂੰ ਸਿਖਾਉਂਦਾ ਹੈ ਤੇ ਹੋਰ ਗੱਲਾਂ ਬਾਰੇ ਦੱਸਦਾ ਹੈ ਤੇ ਮੈਨੂੰ ਇੰਨਾ ਨੋ ਇਹਨਾਂ ਬਾਰੇ ਨੋਲੇਜ ਦਿੰਦਾ ਹੈ ਮੈਂ ਸੁਬਹਾ ਜਲਦੀ ਉੱਠਦੀ ਆਂ ਤੇ ਆਪਦਾ ਪਰਮਾਤਮਾ ਦਾ ਨਾਮ ਜਪ ਕੇ ਸੈਰ ਕਰਨ ਲਈ ਜਾਨੀ ਹੈ ਤੇ ਮੇਰਾ ਬੇਟਾ ਵੀ ਮੇਰੇ ਨਾਲ ਹੀ ਜਾਂਦਾ ਉਹ ਇਹੋ ਜਿਹੀ ਘੜੀ ਨੂੰ ਮੇਰੇ ਗੁੱਟ ਤੇ ਬੰਨ ਦਿੰਦਾ ਹੈ ਮੈਨੂੰ ਆਪੇ ਦਾ ਆਪ ਪਤਾ ਲੱਗਦਾ ਰਹਿੰਦਾ ਵੀ ਕਿੰਨੇ ਸਟੈੱਪ ਮੈਂ ਤੁਰਦੀ ਆ ਮੇਰਾ ਬੀ ਪੀ ਵੱਧਦਾ ਸੀ ਮੈਂ ਇਹਦੇ ਨਾਲ ਠੀਕ ਹੋਣ ਲੱਗ ਪਈ ਸੈਰ ਨਾਲ ਮੈਂ ਰੋਜ ਸੁਬਹਾ ਜਲਦੀ ਉੱਠ ਕੇ ਸੈਰ ਕਰਨ ਜਾਂਦੀ ਆ ਤੇ ਇੰਨੇ ਨਾਲ ਮੇਰਾ ਵਜਨ ਬੀਜ ਵੀ ਪ੍ਰੋਬਲਮ ਘੱਟ ਗਈ ਐ ਤੇ ਮੈਂ ਇਨੇ ਨਾਲ ਸਿਹਤ ਮੰਦ ਰਹਿਣ ਲੱਗ ਪਈ ਐ ਰੋਜ਼ ਰੁਟੀਨ ਵਾਜ ਮੇਰਾ ਬੇਟਾ ਮੇਰੇ ਨਾਲ ਜਾਂਦਾ ਹ ਤੇ ਸੁਬਹਾ ਅਸੀਂ ਜਲਦੀ ਉੱਠ ਪੈਨੇ ਆ ਤੇ ਅਸੀਂ ਐਕਸਰਸਾਈਜ਼ ਨਹੀਂ ਤੁਰ ਜਾਦੇ ਹਾਂ ਤੇ ਹੌਲੀ ਹੌਲੀ ਅਸੀਂ ਆਪਣੇ ਗੁਰਦੁਆਰਾ ਸਾਹਿਬ ਵਿੱਚ ਵੀ ਐਕਸਰਸਾਈਜ ਦੀਆਂ ਮਸ਼ੀਨਾਂ ਲਾਈਆਂ ਹੋਣੀਆਂ ਹਨ ਅਸੀਂ ਰੋਜ਼ ਐਕਸਰਸਾਈਜ਼ ਕਰਕੇ ਆਉਣੇ ਆ ਤੇ ਮੇਰਾ ਬੇਟਾ ਮੈਨੂੰ ਦੱਸ ਦਿੰਦਾ ਵੀ ਇਸ ਤਰ੍ਹਾਂ ਐਕਸਚੇਂਜ ਕਰੋ ਤੇ ਆਪਣਾ ਵਜਨ ਘਟਾਓ ਤੇ ਮੇਰਾ ਬੀ ਪੀ ਵੀ ਸੈਰ ਰਹਿਣ ਲੱਗ ਪਿਆ ਇਹਨੇ ਨਾਲ ਮੈਨੂੰ ਰਾਤ ਨੂੰ ਨੀਂਦ ਵੀ ਆਉਣੀ ਸੌਖੀ ਹੋ ਜਾਂਦੀ ਹੈ ਤੇ ਕਦੇ ਮੈਨੂੰ ਨੀਂਦ ਨਹੀਂ ਆਉਂਦੀ ਸੀ ਹੁਣ ਮੈਂ ਰੋਜ਼ ਸੌਖੀ ਨੀਂਦ ਸੌ ਜਾਦੀ ਹ ਤੇ ਸੁਬਹਾ ਜਲਦੀ ਉੱਠ ਪੈਣੀ ਹ ਇਹਨੇ ਨਾਲ ਫਿਰ ਮੈਂ ਆਪਦੇ ਕੰਮ ਕਾਰ ਕਰਕੇ ਫਿਰ ਮੈਂ ਆਪਦੇ ਬੇਟੇ ਨਾਲ ਤੇ ਸੈਰ ਕਰਨ ਲਈ ਤੁਰ ਜਾਨੀ ਹੈ ਸ਼ਾਮ ਨੂੰ ਅਸੀਂ ਫਿਰ ਜਾ ਕੇ ਐਕਸਰਸਾਈਜ਼ ਕਰ ਲੈਦੇ ਹਾਂ ਤੇ ਹੌਲੀ ਹੌਲੀ ਆਪਣੇ ਵਜਨ ਘਟਾ ਦਿੰਨੀ ਹੈ ਤੇ ਬੀ ਪੀ ਵੀ ਸੈਟ ਰਹਿਣ ਲੱਗ ਪਿਆ ਇਹਨੇ ਨਾਲ